ਹਾਂ ਮੈਂ ਬਹੁਤ ਜਗ੍ਹਾ 'ਤੇ ਕੁਦਰਤੀ ਸੈਰ ਕੀਤੀ ਹੋਈ ਆ ਮੈਨੂੰ ਬਾਹਰ ਘੁੰਮਣਾ ਬਹੁਤ ਵਧੀਆ ਲੱਗਦਾ ਵਾ ਮੈਂ ਬਹੁਤ ਘੁੰਮੀ ਹੋਈ ਹਾਂ ਮੈਂ ਮਨਾਲੀ ਮੰਸੂਰੀ ਹਰਿਦੁਆਰ ਸਭ ਕਿੱਥੇ ਰਿਸ਼ੀਕੇਸ਼ ਸਭ ਕਿੱਥੇ ਮੈਂ ਗਈ ਹੋਈ ਹਾਂ ਮੈਨੂੰ ਘੁੰਮਣਾ ਬਹੁਤ ਪਸੰਦ ਆ ਅਤੇ ਮੈਂ ਹਾਂ ਉੱਥੇ ਜਾ ਕੇ ਬੜੀ ਚੀਜ਼ਾਂ ਮੈਂ ਵੇਖੀ ਸੀ ਮੈਂ ਆਪਣੀ ਛੁੱਟੀਆਂ 'ਚ ਗਈ ਸੀ ਜਦੋਂ ਮੈਨੂੰ ਕੋਲਜ ਦੀਆਂ ਛੁੱਟੀਆਂ ਸੀ ਉਦੋਂ ਮੈਂ ਗਈ ਸੀ ਗਰਮੀ ਦੀ ਛੁੱਟੀਆਂ 'ਚ ਮੈਂ ਇੱਕ ਵਾਰੀ ਮੰਸੂਰੀ ਗਈ ਸੀ ਇੱਕ ਵਾਰੀ ਮੈਂ ਮਨਾਲੀ ਗਈ ਸੀ ਅਤੇ ਉੱਥੇ ਮੈਨੂੰ ਨਾ ਬਹੁਤ ਮਜ਼ਾ ਆਇਆ ਗਰਮੀਆਂ 'ਚ ਠੰਡੀ ਠੰਡੀ ਜਗ੍ਹਾ 'ਤੇ ਜਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਵਾ ਅਤੇ ਉੱਥੇ ਮੈਂ ਬਹੁਤ ਇੰਜੋਏ ਕੀਤਾ ਉੱਥੇ ਮੈਂ ਘੁੰਮੀ ਫਿਰੀ ਰਹੀ ਨਾਲ ਆਪਣੀ ਖਾਧਾ ਪੀਤਾ ਨਵੀਂ ਚੀਜ਼ਾਂ ਖਾਧੀਆਂ ਨਵਾਂ ਸਭ ਕੁਛ ਐਕਸਪੀਰੀਅੰਸ ਕੀਤਾ ਮੈਂ ਉੱਥੇ ਜਦੋਂ ਮੈਂ ਮਨਾਲੀ ਗਈ ਸੀ ਮਨਾਲੀ ਜਾ ਕੇ ਮੈਂ ਉੱਥੇ ਜੀਪ ਜਿਪ ਸਾਈਨ ਕੀਤੀ ਉਹ ਮੈਂ ਰਾਫਟਿੰਗ ਕੀਤੀ ਬਹੁਤ ਮਜ਼ਾ ਆਇਆ ਮੈਨੂੰ ਘੁੰਮਣ ਫਿਰਨ ਦਾ ਅਸੀਂ ਵੇਖਿਆ ਤਿੰਨ ਚਾਰ ਦਿਨ ਅਸੀਂ ਉੱਥੇ ਰਹੇ ਸੀ ਅਤੇ ਉੱਥੇ ਅਸੀਂ ਟੈਂਪਲਸ ਵੀ ਦੇਖੇ ਅਤੇ ਨਾਲ ਅਸੀਂ ਉੱਥੇ ਕਈ ਵੱਖਰੇ ਵੱਖਰੇ ਟੈਂਪਲਜ਼ ਸਭ ਕੁਛ ਦੇਖਿਆ ਨਾਲ ਅਸੀਂ ਮਨੀਕਰਨ ਵੀ ਗਏ ਮਨੀਕਰਨ ਗੁਰਦੁਆਰਾ ਪਲੱਸ ਸ਼ਿਵਜੀ ਦਾ ਮੰਦਰ ਹੈ ਉੱਥੇ ਇੱਕ ਪਾਸੇ ਠੰਡਾ ਪਾਣੀ ਆਉਂਦਾ ਇੱਕ ਪਾਸੇ ਗਰਮ ਪਾਣੀ ਆਉਂਦਾ ਵਾ ਜੋ ਕਿ ਬਹੁਤ ਵਧੀਆ ਸੀ ਦੇਖਣਾ ਬਹੁਤ ਮਜ਼ਾ ਆਇਆ ਅਸੀਂ ਬਹੁਤ ਇੰਜੋਏ ਕੀਤਾ ਅਤੇ ਹਰਿਦੁਆਰ ਤੋਂ ਵੈਸੇ ਤੁਹਾਨੂੰ ਪਤਾ ਧਾਰਮਿਕ ਅਸਥਾਨ ਆ ਆਰਤੀ ਕਰਨ ਦੇ ਕਿੰਨ ਮਤਲਬ ਦੇਖਣ ਦਾ ਕਿੰਨਾਂ ਮਜ਼ਾ ਆਉਂਦਾ ਵਾ ਗੰਗਾ ਆਰਤੀ ਅਤੇ ਰਿਸ਼ੀਕੇਸ਼ ਵੀ ਕਿੰਨੀ ਰਾਫਟਿੰਗ ਸਭ ਕੁਛ ਰਿਪਲਾਈਨ ਕਿੰਨਾਂ ਕੁਛ ਹੁੰਦਾ ਵਾ ਅਤੇ ਉੱਥੇ ਵੀ ਘੁੰਮਣ ਦਾ ਕਿੰਨਾਂ ਮਜ਼ਾ ਆਉਂਦਾ ਵਾ ਤੁਸੀਂ ਉੱਥੇ ਕਾਫੀ ਐਕਟੀਵਿਟੀਜ਼ ਕਰ ਸਕਦੇ ਹੋ ਰਿਸ਼ੀਕੇਸ਼ 'ਚ ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਮੈਂ ਬਹੁਤ ਘੁੰਮੀ ਹੋਈ ਹਾਂ ਬਹੁਤ ਥਾਵਾਂ 'ਤੇ ਮੈਂ ਗਈ ਹੋਈ ਹਾਂ ਬਹੁਤ ਵਧੀਆ ਸੀ ਐਕਸਪੀਰੀਅੰਸ ਮੇਰਾ ਵਧੀਆ ਹੀ ਥੈਂਕ ਧੰਨਵਾਦ